ਜੀ ਬਿਲਕੁਲ ਜਾਣੂ ਹਾਂ ਜੀ ਤਕਰੀਬਨ ਕਈ ਅਸੀਂ ਗੱਲਾਂ ਵਿੱਚ ਦੇਖਿਆ ਜਾਂਦਾ ਜਿਵੇਂ ਕੋਈ ਵਿਚਾਰਾ ਮਰੀਜ਼ ਆਇਆ ਹੁੰਦਾ ਉਹਨੂੰ ਠੱਗਣ ਵਾਲੇ ਪਹਿਲਾਂ ਹੀ ਉੱਥੇ ਤੁਰੇ ਫਿਰਦੇ ਆ ਕਰਿੰਦੇ ਉਹ ਬਾਹਰੋਂ ਨਹੀਂ ਹੁੰਦੇ ਇਹਨਾਂ ਦੇ ਆਪਣੀ ਹੀ ਹੁੰਦੇ ਆ ਦਵਾਈਆਂ ਜਿਹੜੀਆਂ ਹਸਪਤਾਲਾਂ 'ਚ ਹੁੰਦੀਆਂ ਉੱਥੋਂ ਨਹੀਂ ਦਿੱਤੀਆਂ ਜਾਂਦੀਆਂ ਸਪੈਸ਼ਲ ਲਿਖੀਆਂ ਜਾਂਦੀਆਂ ਕਿ ਬਾਹਰੋਂ ਲੈ ਕੇ ਆਓ ਕਮਿਸ਼ਨ ਆਪਣਾ ਆਪਣਾ ਮੁਨਾਫਾ ਵੇਖਣਾ ਹੁੰਦਾ ਹਰ ਇੱਕ ਨੇ ਚਲੋ ਨਾਂ ਨਹੀਂ ਲੈਣਾ ਆਪਾਂ ਕਿਸੇ ਦਾ ਵੀ ਜਿਹੜਾ ਸਮਾਨ ਹਸਪਤਾਲ 'ਚੋਂ ਫਰੀ 'ਚ ਮਿਲਣਾ ਚਾਹੀਦਾ ਉਹ ਹੀ ਸਮਾਨ ਬਾਹਰੋਂ ਜਿਹੜੇ ਮੈਡੀਕਲ ਸਟੋਰ ਆ ਉੱਥੋਂ ਮਿਲਿਆ ਜਾਂਦਾ ਉਹ ਕਿਉਂ ਜਿਹੜੀਆਂ ਦਵਾਈਆਂ ਡੋਕਟਰ ਨੇ ਲਿਖ ਕੇ ਦੇਣੀਆਂ ਹਸਪਤਾਲ 'ਚੋਂ ਬਾਅਦ 'ਚੋਂ ਮਿਲਦੀਆਂ ਨਹੀਂ ਉਹ ਦਵਾਈਆਂ ਉਹਦਾ ਕਾਰਨ ਕੀ ਹੈ ਉਹ ਤਾਂ ਪਹਿਲਾਂ ਹੋਣੀ ਚਾਹੀਦੀਆਂ ਪਤਾ ਹੋਣਾ ਚਾਹੀਦਾ ਉੱਥੇ ਜਿਹੜੇ ਅੰਦਰ ਬਣਾਏ ਦੇ ਆ ਇਹਨਾਂ ਨੇ ਮੈਡੀਕਲ ਸਟੋਰ ਕਿ ਕਿਹੜੀਆਂ ਦਵਾਈਆਂ ਡੋਕਟਰ ਉਹ ਨੂੰ ਚਾਹੀਦੀਆਂ ਵਾ ਜਿਹੜੀਆਂ ਦਵਾਈਆਂ ਡੋਕਟਰ ਡੋਕਟਰ ਉਹ ਦਵਾਈਆਂ ਕਿਉਂ ਨਹੀਂ ਲਿਖ ਕੇ ਦਿੰਦੇ ਮਰੀਜ਼ਾਂ ਨੂੰ ਜਿਹੜੀਆਂ ਅੰਦਰ ਪਈਆਂ ਹਮੇਸ਼ਾਂ ਬਾਹਰ ਵਾਲੀਆਂ ਕਿਉਂ ਲਿਖ ਕੇ ਦਿੰਦੇ ਆ ਟੈਸਟ ਅੰਦਰ ਦੀ ਬਜਾਏ ਹਮੇਸ਼ਾਂ ਬਾਹਰੋਂ ਕਿਉਂ ਕਰਾਏ ਜਾਂਦੇ ਆ ਕਿ ਨਹੀਂ ਜੀ ਨਹੀਂ ਅੰਦਰ ਮਸ਼ੀਨਾਂ ਠੀਕ ਨਹੀਂ ਹੈਗੀਆਂ ਬਾਹਰ ਵਾਲੇ ਟੈਸਟ ਕਰਾਓ ਬਾਹਰ ਵਾਲੇ ਟੈਸਟ ਵਧੀਆ ਇੱਦਾਂ ਹੀ ਕਿਉਂ ਹੁੰਦਾ ਜੇ ਕਿਸੇ ਨੂੰ ਬਲੱਡ ਦੀ ਰੇਂਜ ਪੈ ਜੇ ਜ਼ਰੂਰਤ ਪੈ ਜੇ ਕਿ ਕਿਸੇ ਨੂੰ ਖੂਨ ਚਾਹੀਦਾ ਵਾ ਉਹ ਦੇ ਜਿਹੜੀ ਮੈਡੀਕਲ ਸਟੋਰ ਆ ਉੱਥੋਂ ਮਿਲਿਆ ਜਾਂਦਾ ਉਹ ਕਿਉਂ ਉਹਦੇ ਕਿਉਂ ਪੈਸੇ ਲੱਗਦੇ ਆ ਮਿੰਟੋ ਮਿੰਟ ਪੈਸੇ ਦਿਓ ਅਤੇ ਜਿੰਨਾ ਮਰਜ਼ੀ ਬਲੱਡ ਲੈ ਲਓ ਹਰ ਜਗ੍ਹਾ ਜਿੱਥੇ ਮਰਜ਼ੀ ਚਲ ਜਾਓ ਹਰ ਜਗ੍ਹਾ ਭ੍ਰਿਸ਼ਟਾਚਾਰ ਹਰ ਜਗਾ ਦਵਾਈਆਂ ਦੇ ਨਾਮ 'ਤੇ ਠੱਗਿਆ ਜਾ ਰਿਹਾ ਲੋਕਾਂ ਨੂੰ ਕੀ ਤੁਸੀਂ ਕੁਛ ਕੀ ਕਰ ਸਕਦੇ ਹੋ ਇਹਦੇ ਬਾਰੇ ਕੁਛ ਨਹੀਂ ਕਰ ਸਕਦੇ ਆਪਾਂ ਜੀ ਇਸ ਬਾਰੇ ਕਿੰਨਾ ਕੁ ਰੋਕਾਂਗੇ ਕਿੰਨਾ ਕੁ ਜਾਗਰੂਕ ਕਰਾਵਾਂਗੇ ਲੋਕਾਂ ਨੂੰ ਅੰਦਰ ਦੀ ਕਰਿੰਦੇ ਮਿਲੇ ਹੁੰਦੇ ਆ ਲਿਆਓ ਜੀ ਤੁਹਾਡਾ ਇਹ ਕੰਮ ਕਰਵਾ ਦਿੰਦੇ ਹਾਂ ਅਤੇ ਇੰਨੇ ਪੈਸੇ ਲੱਗਣਗੇ ਤੁਹਾਨੂੰ ਬੈੱਡ ਦਵਾ ਦਿੰਦੇ ਹਾਂ ਇੰਨੀ ਸੇਵਾ ਕਰ ਦਿਓ ਸਭ ਕੁਛ ਇੱਦਾਂ ਹੀ ਹੁੰਦਾ ਜੀ